ਹੈਲੋ ਵਰਸ਼ਾ ਯਾਰ ਪਤਾ ਕੀ ਹੈ ਮੈਂ ਪੁੱਛਣਾ ਸੀ ਮੈਂ ਸੁਣਿਆ ਸੀ ਕਿ ਆਪਣੀ ਜਿਹੜੀ ਹੈਗੀ ਆ ਕੋਲੇਜ ਦੇ ਵਿੱਚ ਕੁਝ ਸਕੋਲਰਸ਼ਿਪਸ ਹ ਆਈਆਂ ਨੇ

ਹਾਂ ਮੈਂ ਕਰਨੀ ਸੀ ਮੈਂ ਕੁਛ ਸੁਣਿਆ ਸੀ ਇਹਦੇ ਬਾਰੇ ਕਿ ਇਹਦੇ ਵਿੱਚ ਜਿਹੜੇ ਹੈਗੇ ਆ ਮਤਲਬ ਵੀ ਇੱਕ ਪੇਪਰ ਦੇਣਾ ਪੈਂਦਾ ਅਤੇ ਅਗਰ ਪੇਪਰ ਦੇ ਵਿੱਚ ਤੁਹਾਡੇ ਅੱਸੀ ਪਰਸੈਂਟ ਮਤਲਬ ਮੈਰਿਟ ਦੇ ਵਿੱਚ ਅਗਰ ਤੁਸੀਂ ਆਉਂਦੇ ਹੋ ਤਾਂ ਹੋਏਗਾ ਐਦਾਂ ਕੁਛ ਹੈਗਾ ਕੁਛ ਜਾਂ ਫਿਰ ਇਹਦੇ ਬਾਰੇ ਫਾਰਮ ਕੀ ਨੇ ਤੈਨੂੰ ਪਤਾ ਹੈ ਕੁਛ

ਹਾਂ ਮੈਨੂੰ ਵੀ ਲੱਗਦਾ ਕਿਉਂਕਿ ਮੈਨੂੰ ਲੱਗਦਾ ਕਿ ਇਹਦੇ ਵਿੱਚ ਹੋਰ ਵੀ ਕੁਝ ਨਵੀਆਂ ਚੀਜ਼ਾਂ ਐਡ ਹੋਈਆਂ ਨੇ ਕਿ ਲਾਈਕ ਮੈਨੂੰ ਲੱਗਦਾ ਵੀ ਕਾਸਟ ਦਾ ਸਿਸਟਮ ਦਾ ਕੁਝ ਚੱਕਰ ਹੈ ਕਿ ਕਿਹੜੀ ਕਾਸਟ ਲਈ ਕਿੰਨਾ ਕੁ ਪਰਸੈਂਟੇਜ ਹੋਏਗਾ ਲਾਈਕ ਮੈਨੂੰ ਲੱਗਦਾ ਕਿ ਐੱਸ ਸੀ ਲਈ ਵੀਹ ਪਰਸੈਂਟ ਹੈ ਅਤੇ ਜਰਨਲ ਲਈ ਸਿਰਫ਼ ਦਸ ਕੁ ਜਾਂ ਪੰਜ ਪਰਸੈਂਟ ਹੈ ਅਤੇ ਮੈਨੂੰ ਲੱਗਦਾ ਕਿ ਆਪਾਂ ਨਾ ਇਹ ਸਰ ਤੋਂ ਕਲੀਅਰ ਕਰ ਲਾਂਗੇ ਇੱਕ ਵਾਰੀ ਜਾ ਕੇ ਸਰ ਨੂੰ ਪੁੱਛ ਕੇ ਕੋਲੇਜ ਜਾ ਕੇ ਠੀਕ ਹੈ ਫਿਰ ਆਪਾਂ ਫਿਰ ਕੱਲ੍ਹ ਮਿਲਦੇ ਹਾਂ ਠੀਕ ਹੈ ਓਕੇ ਬਾ ਬਾਏ